ਮੈਨੂੰ ਖੇਤੀਬਾੜੀ ਬਹੁਤ ਪਸੰਦ ਹੈ ਪਰ ਅੱਜ ਕੱਲ੍ਹ ਖੇਤੀਬਾੜੀ ਵਿੱਚ ਬਹੁਤ ਸਾਧਨ ਆ ਗਏ ਹਨ ਪਹਿਲਾਂ ਖੇਤੀਬਾੜੀ ਬਲਦਾਂ ਨਾਲ ਕੀਤੀ ਜਾਂਦੀ ਸੀ ਪਰ ਹੁਣ ਟਰੈਕਟਰਾਂ ਦਾ ਪ੍ਰਯੋਗ ਹੋਣ ਲੱਗ ਗਿਆ ਹੈ ਹੁਣ ਬੜੀ ਬੜੀ ਮਸ਼ੀਨਾਂ ਆ ਗਈਆਂ ਹਨ ਜਿਹਨਾਂ ਕਰਕੇ ਖੇਤੀ ਕਰਨ ਵਿੱਚ ਬਹੁ ਆਸਾਨੀ ਹੁੰਦੀ ਹੈ ਅਤੇ ਇਹ ਬਹੁਤ ਜਲਦੀ ਵੀ ਹੋ ਜਾਂਦਾ ਹੈ ਟਰੈਕਟਰ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਆਉਂਦੀਆਂ ਹਨ ਅਲੱਗ ਅਲੱਗ ਪ੍ਰਕਾਰ ਦੀਆਂ ਮਸ਼ੀਨਾਂ ਹਨ ਜਿਹਨਾਂ ਵਿੱਚ ਆਟੋਮੈਟਿਕ ਬੀਜ ਪੈ ਜਾਂਦਾ ਹੈ ਅਤੇ ਬੀਜਾਂ ਨੂੰ ਜਲਦੀ ਉਗਾਉਣ ਲਈ ਬਹੁਤ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਆਉਂਦੀਆਂ ਹਨ ਜਿਹੜੇ ਫਸਲਾਂ ਨੂੰ ਬਹੁਤ ਜਲਦੀ ਵਧਾਉਂਦੀਆਂ ਹਨ ਅਤੇ ਇੱਦਾਂ ਦੀਆਂ ਕਈ ਦਵਾਈਆਂ ਵੀ ਹਨ ਜਿਹੜੇ ਫਸਲਾਂ ਨੂੰ ਕੀੜੇ ਨਹੀਂ ਲੱਗਣ ਦਿੰਦੀਆਂ ਇਸ ਕਰਕੇ ਜਿਹੜੇ ਪੰਜਾਬ ਵਿੱਚ ਹੈ ਖੇਤੀਬਾੜੀ ਵੱਧਦੀ ਜਾਂਦੀ ਹੈ ਜਿਹੜੇ ਮਸ਼ੀਨ ਹੈ ਉਹ ਅੱਜ ਕੱਲ੍ਹ ਆਟੋਮੈਟਿਕ ਆ ਗਏ ਹਨ ਜਿਹਨਾਂ ਕਰਕੇ ਫਸਲਾਂ ਵਿੱਚ ਵਾਧਾ ਵੀ ਹੁੰਦਾ ਹੈ ਅਤੇ ਕਈ ਮਸ਼ੀਨ ਪੰਪਾਂ ਵਾਲੇ ਆਟੋਮੈਟਿਕ ਹਨ ਜਿਹਨਾਂ ਕਰਕੇ ਦਵਾਈਆਂ ਛਿੜਕਣ ਵਿੱਚ ਬਹੁਤ ਆਸਾਨੀ ਹੁੰਦੀ ਹੈ ਅਤੇ ਬਹੁਤ ਜਲਦੀ ਦਵਾਈਆਂ ਛਿੜਕ ਦਿੰਦੇ ਹਨ ਅਤੇ ਸਾਡੇ ਖੇਤ ਦੇ ਨਾਲ ਹੀ ਇੱਕ ਛੋਟੀ ਜਿਹੀ ਨਹਿਰ ਵੱਗਦੀ ਹਨ ਜਿਸ ਕਰਕੇ ਖੇਤ ਨੂੰ ਪਾਣੀ ਲਾਣਾ ਵੀ ਬਹੁਤ ਆਸਾਨ ਹੋ ਜਾਂਦਾ ਹੈ